ਮੈਂ ਛੋਟੀ ਉਮਰ ਤੋਂ ਹੀ ਫੋਟੋਆਂ ਖਿੱਚਣ ਦਾ ਬਹੁਤ ਜ਼ਿਆਦਾ ਸ਼ੌਕ ਰੱਖਦੀ ਸੀ ਛੋਟੇ ਹੁੰਦੇ ਹੀ ਤੋਂ ਫ਼ੋਨ ਵਿੱਚ ਫੋਟੋਆਂ ਖਿੱਚਣੀਆਂ ਫੇਰ ਉਸ ਤੋਂ ਬਾਅਦ ਕੈਮਰੇ ਸ਼ੁਰੂ ਹੋ ਗਏ ਉਸ ਤੋਂ ਫੋ ਉਸ 'ਤੇ ਉਸ 'ਤੇ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਜਦੋਂ ਜਦੋਂ ਵੀ ਘਰ ਦਾ ਕੋਈ ਘਰੇਲੂ ਕੋਈ ਵੀ ਮਤਲਬ ਫੰਕਸ਼ਨ ਹੁੰਦਾ ਸੀ ਉਹ 'ਚ ਫੋਟੋਆਂ ਖਿੱਚਦੀ ਹੁੰਦੀ ਸੀ ਮੈਨੂੰ ਜ਼ਿਆਦਾ ਬਹੁਤ ਜ਼ਿਆਦਾ ਫੋਟੋਗ੍ਰਾਫਰ ਦਾ ਸ਼ੌਕ ਸੀ ਅਤੇ ਹੁਣ ਹੁਣ ਹਰ ਇੱਕ ਚੀਜ਼ ਵਿੱਚ ਫੋਟੋਆਂ ਖਿੱਚ ਖਿੱਚਣ ਦਾ ਮੈਂ ਸ਼ੌਕ ਰੱਖਦੀ ਹਾਂ ਫੋਟੋਆਂ ਇੱਕ ਇਹੋ ਜਿਹੀ ਚੀਜ਼ ਹੋ ਗਈ ਹੋਈ ਹੈ ਕਿ ਫੋਟੋ ਖਿੱਚਣ ਤੋਂ ਬਿਨਾਂ ਨਹੀਂ ਰਿਹਾ ਜਾਂਦਾ